ਮੁਰਗੀ ਪਾਲਣ ਵਿੱਚ ਜੈਵਿਕ ਰਵਾਇਤੀ ਉਤਪਾਦਨ ਪ੍ਰਣਾਲੀਆਂ ਦੇ ਬਹੁਤ ਹੀ ਫਾਇਦੇ ਤੇ ਨੁਕਸਾਨ ਹਨ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਮੁਰਗੀ ਪਾਲਣ ਨੂੰ ਸਭ ਤੋਂ ਵੱਡਾ ਮੁਨਾਫਾ ਗਿਣਿਆ ਜਾਂਦਾ ਕਿ ਇਹਦੇ ਚੋਂ ਆਪਾਂ ਬਹੁਤ ਮੁਨਾਫਾ ਕਮਾ ਸਕਦੇ ਆਂ ਮੁਰਗੀ ਪਾਲਣ ਦੇ ਬਿਜ਼ਨਸ ਵਿੱਚ ਅਸੀਂ ਘੱਟ ਪੈਸੇ ਲਾ ਕੇ ਵੀ ਇੱਕ ਵਧੀਆ ਬਿਜ਼ਨਸ ਆਪਦਾ ਸ਼ੁਰੂ ਕਰ ਸਕਦੇ ਆਂ ਪਹਿਲਾਂ ਦੇ ਸਮੇਂ ਚ ਕੀ ਹੁੰਦਾ ਸੀ ਕੀ ਲੋਗਾ ਦਾ ਮੰਨਣਾ ਇਹ ਸੀ ਕਿ ਖੇਤੀ ਚੋਂ ਜਾਂ ਫਿਰ ਮੁਰਗੀ ਪਾਲਣ ਚੋਂ ਆਪਾਂ ਇੱਕ ਵਧੀਆ ਸਕਸੈਸਫੁਲ ਬਿਜ਼ਨਸ ਕਰ ਸਕਦੇ ਆਂ ਮੁਰਗੀ ਪਾਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕੀ ਸ਼ੁਰੂਆਤ ਚ ਆਪਾਂ ਨੂੰ ਜਿਆਦਾ ਰਾਸ਼ੀ ਨਹੀਂ ਲਾਉਣੀ ਪੈਂਦੀ ਇਹਦੇ ਤੇ ਜਿਆਦਾ ਕੀਮਤ ਨਹੀਂ ਲਾਉਣੀ ਪੈਂਦੀ ਸ਼ੁਰੂ ਵਿੱਚ ਅਸੀਂ ਘੱਟ ਰਾਸ਼ੀ ਲਾ ਕੇ ਵੀ ਇੱਕ ਵਧੀਆ ਮੁਰਗੀ ਪਾਲਣ ਦਾ ਬਿਜ਼ਨਸ ਹੈ ਜਿਹੜਾ ਉਹ ਸ਼ੁਰੂ ਕਰ ਸਕਦੇ ਆਂ ਮੁਰਗੀ ਪਾਲਨ ਜਦੋਂ ਤੱਕ ਆਪਾਂ ਕੋਈ ਵੱਡਾ ਮੁਰਗੀ ਪਾਲਨ ਨਹੀਂ ਖੋਲਣਾ ਚਾਹੁੰਦੇ ਉਦੋਂ ਤੱਕ ਆਪਾਂ ਨੂੰ ਕੋਈ ਜਿਆਦਾ ਜਗ੍ਹਾ ਦੀ ਵੀ ਜਰੂਰਤ ਨਹੀਂ ਹੁੰਦੀ ਆਪਾਂ ਆਪਣੇ ਹੀ ਘਰ ਵਿੱਚ ਜਾਂ ਪਿੰਡ ਵਿੱਚ ਕਿਸੇ ਖਾਲੀ ਜਗ੍ਹਾ ਤੇ ਮੁਰਗੀ ਪਾਲਣ ਸ਼ੁਰੂ ਕਰ ਸਕਦੇ ਆ ਜਿਵੇਂ ਕਿ ਜੈਵਿਕ ਤੇ ਰਿਵਾਇਤੀ ਵਿੱਚ ਇਹ ਹੈ ਕਿ ਜਿਵੇਂ ਕਿ ਨੈਚੁਰਲ ਪ੍ਰੋਸੈਸ ਨਾਲ ਮੁਰਗੀ ਪਾਲਣ ਕਰ ਸਕਦੇ ਆਂ ਜਾਂ ਫਿਰ ਰਵਾਇਤੀ ਚ ਇਹ ਹੈ ਕਿ ਜਿਵੇਂ ਕਿ ਅੱਜ ਕੱਲ ਬਰੈਲਰ ਵਾਲੇ ਮੁਰਗੇ ਆ ਜਿਹੜੇ ਉਹ ਯੂਜ ਕੀਤੇ ਜਾਂਦੇ ਆ ਪਰ ਸਾਨੂੰ ਜੈਵਿਕ ਤੌਰ ਤੇ ਹੀ ਸ਼ੁਰੂ ਕਰ